ਅੱਛਾ ਪੰਜਾਬੀ ਭਾਸ਼ਾ ਦੇ ਬਾਰੇ ਇਹ ਦੱਸਿਆ ਹੈ ਇਹ ਵੱਖਰੇ ਵੱਖਰੇ ਰਾਜਾਂ ਦੇ ਵਿੱਚ ਵੱਖਰੀ ਵੱਖਰੀ ਭਾਸ਼ਾ ਹੁੰਦੀ ਹੈ ਪੰਜਾਬੀ ਭਾਸ਼ਾ ਇਸ ਕਰਕੇ ਵੱਖਰੀ ਹੈ ਕਿ ਬਾਕੀ ਇਲਾਕਿਆਂ ਦੇ ਵਿੱਚ ਇੰਨੀ ਵਧੀਆ ਕਰਕੇ ਨਹੀਂ ਬੋਲੀ ਜਾਂਦੀ ਇਹ ਪੰਜਾਬੀ ਠੇਠ ਪੰਜਾਬੀ ਹੈ ਕਿਉਂਕਿ ਪੰਜਾਬੀ ਦੇ ਵਿੱਚ ਕਈ ਬਹੁਤ ਗੱਲ ਸਭ ਸਮਝਦੇ ਹਨ ਕੋਈ ਇੱਦਾਂ ਬਾਕੀ ਦੂਜੀ ਭਾਸ਼ਾ ਜਿੱਦਾਂ ਹਿੰਦੀ ਮਰਾਠੀ ਬ ਹਿਮਾਲਿਆਂ ਦੀ ਹੁੰਦੀਆਂ ਨੇ ਉਹਨਾਂ ਇੰਨੀ ਅੱਛੀ ਤਰ੍ਹਾਂ ਨਹੀਂ ਬੋਲੀਆਂ ਜਾਂਦੀਆਂ ਅਤੇ ਪੰਜਾਬੀ ਠੇਠ ਪੰਜਾਬੀ ਆ ਇੰਨਾਂ ਸਾਰਾ ਬੱਚਾ ਬਚਪਨ ਤੋਂ ਹੀ ਪੰਜਾਬ ਦੇ ਵਿੱਚ ਰਹਿਣ ਵਾਲੇ ਨੂੰ ਪੰਜਾਬੀ ਹੀ ਗੁਰਮੁਖੀ ਲਿਪੀ ਹੀ ਸਭ ਤੋਂ ਜ਼ਿਆਦਾ ਪਸੰਦ ਹੈਗੀ ਆ ਕਿਉਂਕਿ ਪੰਜਾਬੀ ਜਿਹੜੀ ਸਾਡੀ ਬੋਲੀ ਹੈ ਨਾ ਇਹ ਸਾਨੂੰ ਪੰਜਾਬ 'ਚ ਰਹਿਣ ਦੇ ਲਈ ਪਹਿਲਾਂ ਜ਼ਰੂਰੀ ਹੈ ਪੰਜਾਬੀ ਬੋਲੀ ਅਸੀਂ ਬੋਲਾਂਗੇ ਅਤੇ ਉਹਦੇ ਨਾਲ ਸਾਨੂੰ ਆਪਣਾ ਪੰਜਾਬ ਦਾ ਯਾਦ ਹੁੰਦਾ ਹੈ ਕਿਉਂਕਿ ਆਪਾਂ ਪੰਜਾਬ ਦੇ ਵਿੱਚ ਰਹਿਣ ਵਾਲੇ ਪੰਜਾਬੀ ਹਾਂ ਇਸ ਕਰਕੇ ਸਾਨੂੰ ਪੰਜਾਬ ਦੀ ਬੋਲੀ ਦਾ ਮਾਣ ਹੈ ਪੰਜਾਬੀ ਬੋਲੀ ਸਾਡੀ ਬਹੁਤ ਸਰਲ ਬੋਲੀ ਹੈ ਸਾਰੀਆਂ ਬੋਲੀਆਂ ਦੇ ਨਾਲ ਉਹ ਸੌਖੀ ਬੋਲੀ ਹੈ ਇਸ ਕਰਕੇ ਆਪਾਂ ਇਹਨੂੰ ਬੋਲਣਾ ਜ਼ਿਆਦਾ ਪਸੰਦ ਕਰਦੇ ਹਾਂ ਬਾਕੀ ਖੇਤਰਾਂ ਨਾਲੋਂ ਵੀ ਆਪਾਂ ਇਸਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੇ ਹਨ ਇਹ ਸਾਡੀ ਬੋਲੀ ਹੈ ਆਪਣੀ ਮਾਂ ਬੋਲੀ ਪੰਜਾਬੀ ਐ ਇਹਨੂੰ ਅਸੀਂ ਗੁਰਮੁਖੀ ਲਿਪੀ ਵੀ ਕਹਿ ਸਕਦੇ ਹਨ ਪੰਜਾਬੀ ਦੇ ਵਿੱਚ ਇਹਨੂੰ ਪੰਜਾਬੀ ਨੂੰ ਬਹੁਤ ਜ਼ਿਆਦਾ ਆਪਣਾ ਹੀ ਪੰਜਾਬੀ ਨੂੰ ਜ਼ਿਆਦਾ ਮਾਣ ਹੈ ਆਪਣੀ ਬੋਲੀ ਦੇ ਉੱਪਰ ਆਪਾਂ ਦੂਸਰੇ ਦੀ ਬੋਲੀ ਦੇ ਵਿੱਚ ਬੋਲਣ ਦੇ ਨਾਲ ਸਾਨੂੰ ਇੰਨਾਂ ਮਾਣ ਨਹੀਂ ਹੈਗਾ ਜਿੰਨਾ ਕਿ ਸਾਨੂੰ ਆਪਣੀ ਪੰਜਾਬੀ ਬੋਲੀ ਬੋਲਣ ਦੇ ਵਿੱਚ ਮਾਣ ਹੈ ਇਸ ਕਰਕੇ ਅਸੀਂ ਪੰਜਾਬ ਦੇ ਵਿੱਚ ਰਹਿਣ ਵਾਲੇ ਹਾਂ ਸਾਨੂੰ ਪੰਜਾਬੀ ਬੋਲੀ ਦੀ ਬਹੁਤ ਜ਼ਿਆਦਾ ਮਹੱਤਤਾ ਰੱਖਣੀ ਚਾਹੀਦੀ ਹੈ ਇਹਨੂੰ ਮੈਂ ਪੰਜਾਬੀ ਬੋਲੀ ਨੂੰ ਸਭ ਤੋਂ ਜ਼ਿਆਦਾ ਪ੍ਰੈਫਰੈਂਸ ਦੇਣੀ ਚਾਹੀਦੀ ਹੈ ਕਿਉਂਕਿ ਪੰਜਾਬ ਦੇ ਲੋਕ ਹੈ ਜੋ ਨੇ ਇਹਨਾਂ ਨੂੰ ਪੰਜਾਬ ਦੇ ਵਿੱਚ ਹੀ ਰਹਿਣ ਦੇ ਨਾਲ ਪੰਜਾਬੀ ਬੋਲੀ ਦਾ ਆਪਣਾ ਬਹੁਤ ਵੱਡਾ ਮਾਣ ਸਮਝਦੇ ਹਨ ਕਿਉਂਕਿ ਪੰਜਾਬ ਦੇ ਰਹਿਣ ਵਾਲੇ ਪਹਿਲੇ ਹੀ ਲੋਕ ਸੋਚਦੇ ਹਨ ਕਿ ਤੁਸੀਂ ਪੰਜਾਬੀ ਆਏ ਜੇ ਕਿਉਂਕਿ ਪੰਜਾਬ ਦੇ ਵਿੱਚ ਪੰਜਾਬੀ ਬੋਲੀ ਦੀ ਪ੍ਰੈਫਰੈਂਸ ਆ ਸਰਕਾਰ ਵੀ ਪੰਜਾਬ ਦੇ ਵਿੱਚ ਰਹਿਣ ਵਾਲਿਆਂ ਨੂੰ ਪੰਜਾਬ ਪੰਜਾਬੀ ਭਾਸ਼ਾ ਦੀ ਪਹਿਲੀ ਭਾਸ਼ਾ ਮੰਨਿਆ ਜਾਂਦਾ ਹੈ ਪੰਜਾਬ ਦੇ ਵਿੱਚ ਵੀ ਪੰਜਾਬੀਆਂ ਨੂੰ ਪਹਿਲੀ ਭਾਸ਼ਾ ਪੰਜਾਬੀ ਮੰਨੀ ਜਾਂਦੀ ਹੈ ਬਾਕੀ ਦੇਸ਼ਾਂ ਦੇ ਵਿੱਚ ਜਿੱਦਾਂ ਹਿੰਦੀ ਨੂੰ ਪਹਿਲੇ ਪ੍ਰੈਫਰੈਂਸ ਦਿੰਦੇ ਹਨ ਇਸੇ ਕਰਕੇ ਇਸਨੂੰ ਪੰਜਾਬ ਦੇ ਵਿੱਚ ਰਹਿਣ ਵਾਲੇ ਨੂੰ ਪੰਜਾਬੀ ਦੀ ਭਾਸ਼ਾ ਦਿੰਦੇ ਆ